ਸਤਿ ਸ਼੍ਰੀ ਅਕਾਲ ਲੋਕ ਖੇਡਾਂ ਲੋਕਾਂ ਨੂੰ ਇਕੱਠੇ ਕਰਦੀਆਂ ਹਨ ਅਤੇ ਟੀਮ ਵਰਕ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੀਆਂ ਹਨ ਖੇਡਾਂ ਸਾਨੂੰ ਕਾਫੀ ਕੁਛ ਸਿਖਾਉਂਦੀ ਹੈ ਸਭ ਤੋਂ ਪਹਿਲਾਂ ਮੈਂ ਫੁੱਟਬਾਲ ਦੀ ਇਗਜਾਮਪਲ ਦੇਣਾ ਚਾਹਾਂਗਾ ਇਹਦੇ ਨਾਲ ਅਸੀਂ ਟੀਮ ਵਰਕ ਸਿੱਖਦੇ ਹਨ ਜਿਸ ਕਰਕੇ ਅਸੀਂ ਇਕੱਠੇ ਕੰਮ ਕਰਕੇ ਜਿੱਤਦੇ ਹਨ ਅਤੇ ਦੂਜੀ ਇਗਜਾਮਪਲ ਮੈਂ ਦੇਣਾ ਚਾਹਾਂਗਾ ਬੈਡਮਿੰਟਨ ਦੀ ਬੈਡਮਿੰਟਨ ਵਿੱਚ ਸਾਨੂੰ ਇੱਕ ਪੋਜੀਟਿਵ ਐਟੀਟਿਊਡ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਜੇ ਅਸੀਂ ਹਾਰਦੇ ਹਾਂ ਜਾਂ ਬਹੁਤ ਘੱਟ ਮਾਰਜਨ ਤੋਂ ਹਾਰਦੇ ਹਾਂ ਉਹਦੇ ਨਾਲ ਅਸੀਂ ਨਿਰਾਸ਼ ਨਹੀਂ ਹੁੰਦੇ ਸ ਸਗੋਂ ਉਹਨੂੰ ਪੋਜਿਟੀਵਿਲੀ ਲੈਂਦੇ ਹਨ ਜਿਸ ਕਰਕੇ ਅਸੀਂ ਅੱਗੇ ਤੋਂ ਹੋਰ ਮਿਹਨਤ ਕਰਦੇ ਹਾਂ ਅਸੀਂ ਖੇਡਾਂ ਨਾਲ ਇੱਕ ਕਮਿਊਨੀਕੇਸ਼ਨ ਸਕਿੱਲ ਵੀ ਸਿੱਖਦੇ ਹਨ ਜਿਹਦਾ ਮਤਲਬ ਕਿ ਗੱਲਬਾਤ ਕਰਨ ਦੀ ਸਕਿੱਲ ਵੀ ਸਾਡੇ ਵਿੱਚ ਆ ਜਾਂਦੀ ਹੈ ਅਤੇ ਇਹ ਸਾਨੂੰ ਲੋਂਗ ਲਾਸਟਿੰਗ ਫਰੈਂਡਸ਼ਿਪ ਮਿਲਦੀ ਹੈ ਜਿਹਦਾ ਮਤਲਬ ਕਿ ਸਾਡੀ ਦੋਸਤੀ ਲੰਬੇ ਸਮੇਂ ਤੱਕ ਚਲਦੀ ਹੈ ਅਤੇ ਖੇਡਾਂ ਦੇ ਇਹ ਫਾਇਦੇ ਹਨ